ਪੰਜਾਬ ਵਿੱਚ ਵਪਾਰਕ ਖੇਤਰ ਸਮਾਜਕ ਅਤੇ ਵਾਤਾਵਰਣ ਸਬੰਧੀ ਮੁੱਦਿਆਂ ਨੂੰ ਹੱਲ ਕਰ ਸਕਦਾ ਹੈ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਸਾਡੀਆਂ ਵਪਾਰਕ ਜਿਹੜੀਆਂ ਕੰਪਨੀਆਂ ਹਨ ਇੰਡਸਟਰੀਆਂ ਲੱਗੀਆਂ ਹੋਈਆਂ ਹਨ ਉਹਦੇ ਵਿੱਚ ਜੋ ਵੀ ਫਾਲਤੂ ਵੇਸਟ ਸਮਾਨ ਹੁੰਦਾ ਹੈ ਉਹ ਸਾਰਾ ਜਿਹੜਾ ਹੈ ਨਾਲ ਲੱਗਦੇ ਪਾਣੀ ਦੇ ਵਿੱਚ ਵਹਾਅ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਕੁਝ ਹਾਨੀਕਾਰਕ ਤੱਤ ਵੀ ਹੁੰਦੇ ਹਨ ਜਿਹਨਾਂ ਨੂੰ ਪਹਿਲਾਂ ਸਾਫ਼ ਨਹੀਂ ਕੀਤਾ ਜਾਂਦਾ ਇਸ ਦੇ ਨਾਲ ਸਾਡਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਇਸ ਤਰ੍ਹਾਂ ਇੰਡਸਟਰੀਆਂ ਤੋਂ ਨਿਕਲਣ ਵਾਲਾ ਧੂਆਂ ਸਾਡੇ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਮਸ਼ੀਨਾਂ ਦਾ ਸ਼ੋਰ ਸਾਡੇ ਸਮਾਜ ਵਿੱਚ ਆਵਾਜ਼ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਸੰਤੁਲਿਤ ਕਰਨ ਦੇ ਲਈ ਇੰਡਸਟਰੀਆਂ ਦੇ ਮਾਲਕਾਂ ਨੂੰ ਚਾਹੀਦਾ ਹੈ ਕਿ ਉਹ ਇਹ ਸਾਰੇ ਸਿਸਟਮ ਨੂੰ ਇੱਕ ਤਰਤੀਬ ਨਾਲ ਚਲਾਉਣ ਕੁਛ ਵੀ ਵਿਸ਼ੈਲੇ ਪਦਾਰਥ ਪਾਣੀ ਦੇ ਵਿੱਚ ਜਾਂ ਖੁੱਲ੍ਹੇ ਦੇ ਵਿੱਚ ਨਾ ਸੁੱਟੇ ਜਾਣ ਉਹਨਾਂ ਦੇ ਵਿੱਚੋਂ ਪਹਿਲਾਂ ਵਿਸ਼ੈਲੇ ਤੱਤ ਬਾਹਰ ਕੱਢ ਲਏ ਜਾਣ ਫਿਰ ਬਚੀ ਖੁਚੀ ਰਹਿੰਦ ਖੂੰਹਦ ਨੂੰ ਸੁੱਟ ਦਿੱਤਾ ਜਾਵੇ ਅਤੇ ਇਹਦੇ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕੁਝ ਕੜੇ ਨਿਯਮ ਲਾਗੂ ਕਰੇ ਜਿਸ ਦੇ ਨਾਲ ਕਿ ਇਹਨਾਂ ਵਪਾਰਕ ਖੇਤਰ ਦੇ ਮਾਲਕਾਂ ਨੂੰ ਥੋੜ੍ਹਾ ਡਰ ਹੋਵੇ ਅਤੇ ਉਹ ਆਪਣੇ ਇਸ ਫਰਜ਼ ਨੂੰ ਚੰਗੀ ਤਰ੍ਹਾਂ ਨੇਪਰੇ ਚਾੜਨ ਸਾਨੂੰ ਦੁਬਾਰਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਨੂੰ ਸੁੱਟਣਾ ਨਹੀਂ ਚਾਹੀਦਾ ਉਹਨਾਂ ਨੂੰ ਦੁਬਾਰਾ ਵਰਤਣਾ ਚਾਹੀਦਾ ਹੈ ਜਿਸ ਨਾਲ ਕਿ ਪ੍ਰਦੂਸ਼ਣ ਘੱਟ ਤੋਂ ਘੱਟ ਹੋਵੇ ਅਤੇ ਸਾਡੀ ਸਿਹਤ ਨਾਲ ਕੋਈ ਵੀ ਖਿਲਵਾੜ ਨਾ ਹੋਵੇ